ਭੰਗੜਾ ਪੰਜਾਬੀ ਗੱਭਰੂਆਂ ਦਾ ਲੋਕ ਨਾਚ ਹੈ ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਹੈ ਗਿੱਧਾ ਅਤੇ ਇੱਕ ਹੈ ਭੰਗੜਾ ਭੰਗੜਾ ਪੰਜਾਬੀ ਗੱਭਰੂਆਂ ਦਾ ਲੋਕ ਨਾਚ ਹੈ ਜਦੋਂ ਕਿ ਗਿੱਦਾ ਮੁਟਿਆਰਾਂ ਦਾ ਭੰਗੜਾ ਤਕਰੀਬਨ ਹਰ ਖੁਸ਼ੀ 'ਤੇ ਮੌਕੇ ਜਿਵੇਂ ਤਿਉਹਾਰਾਂ ਮੇਲਿਆਂ ਤਿਉਹਾਰਾਂ ਹਰੇਕ ਖੁਸ਼ੀ ਦੇ ਮੌਕੇ ਜਨਮਦਿਨ ਮੌਕੇ 'ਤੇ ਅਤੇ ਵਿਆਹਾਂ ਜਾ ਮੰਗਣੇ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤ ਜਿੰਨਾ ਹੀ ਪਰਚੀਨ ਹੈ ਜਦੋਂ ਕਿ ਜਦੋਂ ਪੰਜਾਬੀਆਂ ਦੀਆਂ ਫਸਲਾਂ ਹਰੀਆਂ ਫਸਲਾਂ ਨੂੰ ਵੇਖ ਕੇ ਸੁਨਹਿਰੀ ਛਿੱਟੇ ਪੈਂਦੇ ਵੇਖ ਕੇ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ ਲੰਬੀ ਘਾਲਣਾ ਅਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ ਕੇ ਕਿਸਾਨ ਦਾ ਦਿਲ ਨੱਚ ਉੱਠਦਾ ਹੈ ਮੁੱਢ ਵਿੱਚ ਇਹ ਨਾਚ ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰਸੀਆਂ ਰੀਤੀਆਂ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ ਭੰਗੜੇ ਦਾ ਇਤਿਹਾਸ ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜਿਹੜੇ ਸ਼ੇਖੂਪੁਰਾ ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਹੀ ਜ਼ਿਆਦਾ ਪ੍ਰਚਲਿਤ ਸੀ ਇਸ ਨਾਚ ਦਾ ਸਬੰਧ ਵਿਸਾਖੀ ਦੇ ਸਮੇਂ ਜਦੋਂ ਕਣਕ ਦੀ ਫਸਲਾਂ ਦੀ ਵਾਢੀ ਨਾਲ ਹੈ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਨੇ ਭੰਗੜੇ ਵਿੱਚ ਪੇਂਡੂ ਸਾਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਢੋਲ ਦਾ ਮੁੱਖ ਸਾਜ ਹੈ ਇਸ ਤੋਂ ਬਿਨਾਂ ਹੋਰ ਸਾਜ ਜਿਵੇਂ ਬੁਗਦੂ ਅਲਗੋਜੇ ਤੂੰਬੀਆਂ ਆਦਿ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਲੋਕ ਢੋਲੀ ਦੇ ਦੁਆਲੇ ਘੇਰਾ ਬਣਾ ਲੈਂਦੇ ਹਨ ਅਤੇ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਨੇ ਅਤੇ ਕਦੇ ਗੋਡੇ ਹਿਲਾ ਕੇ ਸਰੀਰ ਨੂੰ ਅੱਗੇ ਝੁਕਾ ਲੈਂਦੇ ਨੇ ਅਤੇ ਭੰਗੜਾ ਇਕੱਲੇ ਪੰਜਾਬ ਹੀ ਨਹੀਂ ਇਕੱਲੇ ਭਾਰਤ ਹੀ ਨਹੀਂ ਸਗੋਂ ਹਰੇਕ ਦੁਨੀਆਂ ਦੇ ਹਰੇਕ ਕੋਨੇ ਵਿੱਚ ਪ੍ਰਚਲਿਤ ਹੈ ਹਰੇਕ ਦੁਨੀਆਂ ਦੇ ਹਰੇਕ ਦੇਸ਼ਾਂ ਵਿੱਚ ਭੰਗੜੇ ਦਾ ਬਾ ਇੱਕ ਮਹੱਤਵਪੂਰਨ ਸਥਾਨ ਹੈ ਹਰੇਕ ਸ਼ੇ ਦੇਸ਼ ਦੇ ਲੋਕ ਖੁਸ਼ੀ ਦੇ ਵਿੱਚ ਆ ਕੇ ਭੰਗੜਾ ਪਾਉਂਦੇ ਹਨ ਅਤੇ ਝੂਮ ਉੱਠਦੇ ਹਨ